ਹਾਂਜੀ ਕੌਣ ਦਿਵਜੋਤ ਹਾਂਜੀ ਮੈਂ ਨਾ ਫਤਿਹਗੜ੍ਹ ਸਾਹਿਬ ਐਡਮਿਸ਼ਨ ਲੈਣੀ ਸੀ ਅਤੇ ਮੈਂ ਬਠਿੰਡੇ ਤੋਂ ਬੋਲ ਰਹੀ ਹਾਂ ਇੰਜੀਨੀਅਰਿੰਗ ਕੋਲਜ ਹੈ ਨਾ ਫਤਿਹਗੜ੍ਹ ਸਾਹਿਬ ਬ ਬਾਬਾ ਬੰਦਾ ਸਿੰਘ ਬਹਾਦਰ ਮੈਂ ਉੱਥੇ ਐਡਮਿਸ਼ਨ ਲੈਣੀ ਸੀ ਅਤੇ ਮੈਂ ਪੁੱਛਣਾ ਸੀ ਵੀ ਉੱਥੋਂ ਦਾ ਕਲਾਈਮੇਟ ਕਿਸ ਤਰ੍ਹਾਂ ਦਾ ਵਾਤਾਵਰਨ ਅਤੇ ਹੋਰ ਬਾਕੀ ਜਾਣਕਾਰੀ ਹਾਂਜੀ ਹਾਂ ਹੋਸਟਲ 'ਚ ਕਿਉਂਕਿ ਮੈਨੂੰ ਬਠਿੰਡਾ ਦੂਰ ਪੈਣਾ ਨਾ ਫਿਰ ਹਮ ਅੱਛਾ ਜੀ ਹਾਂਜੀ ਇਸੇ ਮਹੀਨੇ ਆਉਣ ਦੀ ਸਲਾਹ ਹੈ ਹਾਂਜੀ ਠੀਕ ਹੈ ਜੀ ਅਤੇ ਅੱਛਾ ਜੀ ਠੀਕ ਹੈ ਜੀ ਹਮ ਅੱਛਾ ਅੱਛਾ ਜੀ

ਠੀਕ ਹੈ ਜੀ ਠੀਕ ਹੈ ਜੀ ਅੱਛਾ ਠੀਕ ਹੈ ਅੱਛਾ ਜੀ ਅੱਛਾ ਜੀ ਕੋਈ ਗੱਲ ਨਹੀਂ ਅਤੇ ਹੋਰ ਇੱਥੇ ਮੈਮ ਮਤਲਬ ਕੀ ਕੁਛ ਐ ਦੇਖਣ ਨੂੰ ਅੱਛਾ ਜੀ ਅੱਛਾ ਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਠੀਕ ਹੈ ਹਾਂਜੀ ਹਾਂਜੀ ਹਾਂ ਅੱਛਾ ਹਾਂਜੀ ਹਾਂ ਠੀਕ ਹੈ ਜੀ ਹਾਂਜੀ ਠੀਕ ਹੈ ਅਤੇ ਮੈਮ ਇੱਥੇ ਮਾਰਕੀਟ ਵਗੈਰਾ ਮਾਰਕੀਟ ਵਗੈਰਾ ਨੇੜੇ ਹੀ ਹੈ ਆਪਣੇ ਕੋਲਜ ਦੇ ਠੀਕ ਹੈ ਠੀਕ ਹੈ ਜੀ

ਠੀਕ ਹੈ ਹਾਂਜੀ ਠੀਕ ਹੈ ਜੀ ਚਲੋ ਠੀਕ ਹੈ ਜੀ ਧੰਨਵਾਦ ਬਹੁਤ ਬਹੁਤ ਹਾਂਜੀ ਓਕੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ